ਹੈਲੋ ਸਤਿ ਸ਼੍ਰੀ ਅਕਾਲ ਭਾਅ ਜੀ ਦੀਪ ਟਰੈਵਲਿੰਗ ਜੀ ਮੈਂ ਸਤਨਾਮ ਗੱਲ ਕਰ ਰਿਹਾਂ ਰੋਪੜ ਤੋਂ ਕੱਲ੍ਹ ਆਪਣੀ ਗੱਲ ਹੋਈ ਸੀ ਕੈਬ ਬੁੱਕ ਕਰਨ ਲਈ ਜੀ ਮੈਂ ਹੁਸ਼ਿਆਰਪੁਰ ਜਾਣਾ ਸੀਗਾ ਜ਼ਰੂਰੀ ਕੰਮ ਸੀ ਤਾਂ ਸਵੇਰੇ ਤੁਹਾਡੀ ਕੈਬ ਟਾਈਮ 'ਤੇ ਆ ਗਈ ਸੀਗੀ ਜੀ ਤਾਂ ਮੈਂ ਉਪਰ ਟਾਈਮ 'ਤੇ ਪਹੁੰਚ ਵਿੱਚ ਗਿਆ ਸੀਗਾ ਅਤੇ ਟਾਈਮ 'ਤੇ ਵਾਪਸ ਵੀ ਆ ਰਿਹਾ ਸੀਗਾ ਅਤੇ ਜਦੋਂ ਵਾਪਸ ਆ ਰਹੇ ਸੀ ਰਸਤੇ 'ਚ ਤਾਂ ਡਰਾਈਵਰ ਤੁਹਾਡਾ ਕਿਰਾਏ ਲਈ ਕਹਿ ਰਿਹਾ ਸੀਗਾ ਅਤੇ ਆਪਣੀ ਗੱਲ ਹੋਈ ਸੀਗੀ ਦੋ ਹਜ਼ਾਰ ਦੇ ਵਿੱਚ ਜੀ ਤਾਂ ਉਹ ਪੱਚੀ ਸੌ ਰੁਪਿਆ ਮੰਗਦੇ ਨੇ ਜੀ ਅਤੇ ਜਦੋਂ ਉਹਨਾਂ ਨੂੰ ਮੈਂ ਘਰ ਆ ਕੇ ਦੋ ਹਜ਼ਾਰ ਰੁਪਿਆ ਦਿੱਤਾ ਤਾਂ ਉਹ ਮਨਾ ਕਰ ਰਹੇ ਸੀਗੇ ਕਿ ਨਹੀਂ ਪੱਚੀ ਸੌ ਰੁਪਇਆ ਹੀ ਬਣਦਾ ਏ ਤਾਂ ਆਪਣੀ ਗੱਲ ਸਿਰਫ ਦੋ ਹਜ਼ਾਰ ਵਿੱਚ ਹੋਈ ਸੀਗੀ ਜੀ ਅਤੇ ਤੁਸੀਂ ਮੈਨੂੰ ਆਪ ਦੱਸੋ ਅਤੇ ਆਪਣਾ ਕੋਈ ਅਕਾਊਂਟ ਨੰਬਰ ਗੂਗਲ ਪੇ ਪੇਟੀਐੱਮ ਜੋ ਵੀ ਆ ਦੱਸ ਦਿਉ ਮੈਂ ਉਸ 'ਤੇ ਪੇਮੈਂਟ ਕਰ ਦਿੰਦਾ ਜੀ ਅਤੇ ਆਪਣੀ ਗੱਲ ਦੋ ਹਜ਼ਾਰ ਦੇ ਵਿੱਚ ਹੋਈ ਤਾਂ ਮੈਂ ਦੋ ਹਜ਼ਾਰ ਰੁਪਇਆ ਹੀ ਦੇ ਰਿਹਾ ਅਤੇ ਤੁਹਾਡੇ ਡਰਾਈਵਰ ਬੋਲ ਰਹੇ ਨੇ ਮਤਲਬ ਕਿ ਵੱਧ ਘੱਟ ਬੋਲਦੇ ਨੇ ਕਿ ਵੀ ਕਰਾਇਆ ਘੱਟ ਹੈ ਤਾਂ ਤੁਸੀਂ ਇਹਨਾਂ ਨਾਲ ਆਪ ਗੱਲ ਕਰ ਲਉ ਅਤੇ ਆਪਣੀ ਜਿੰਨੇ 'ਚ ਗੱਲ ਹੋਈ ਸੀਗੀ ਤਾਂ ਮੈਂ ਤੁਹਾਨੂੰ ਪੇਮੈਂਟ ਪਾ ਦਿੰਦਾ ਅਕਾਊਂਟ 'ਚ ਪਾਓਣੇ ਅਕਾਊਂਟ 'ਚ ਪਵਾ ਲਉ ਜੀ ਗੂਗਲ ਪੇ ਪੇਟੀਐੱਮ ਕਰਵਾਉਣਾ ਤਾਂ ਉਹ ਕਰਵਾ ਲਓ ਜੀ ਅਤੇ ਤੁਹਾਡਾ ਬਹੁਤ ਧੰਨਵਾਦ ਜੀ ਬਾਕੀ ਟਾਈਮ 'ਤੇ ਆ ਗਿਆ ਸ ਚਲੇ ਗਿਆ ਸੀਗਾ ਮੈਂ ਜੀ ਅਤੇ ਅੱਗੇ ਵਾਸਤੇ ਥੋੜ੍ਹਾ ਜਿਹਾ ਧਿਆਨ ਰੱਖਿਓ ਕਿ ਇਵੇਂ ਤਾਂ ਡਰਾਈਵਰ ਨਾ ਕਰਿਆ ਕ ਭੇਜਿਆ ਕਰੋ ਜੀ